ਹਾਂਜੀ ਪੰਜਾਬੀ ਭਾਸ਼ਾ ਦਾ ਸਾਡੇ ਜੀਵਨ 'ਚ ਬਹੁਤ ਮਹੱਤਵ ਹੈ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋ ਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤ ਮੇਲ ਜੋਲ ਨਹੀਂ ਹੁੰਦਾ ਸੀ ਇਸ ਤੋਂ ਇਲਾਵਾ ਚਾਰ ਸਾਧਨਾ ਦਾ ਵੀ ਕੋਈ ਬਹੁਤ ਵਿਕਾਸ ਨਹੀਂ ਹੋਇਆ ਸੀ ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਅਤੇ ਸ਼ਬਦਾਵਲੀ ਦੇ ਪੱਖ ਤੋਂ ਥੋੜ੍ਹਾ ਬਹੁਤ ਅੰਤਰ ਜ਼ਰੂਰ ਹੁੰਦਾ ਹੈ ਹੁੰਦਾ ਸੀ ਆਮ ਤੌਰ 'ਤੇ ਦਰਿਆ ਸੰਘਣੇ ਜੰਗਲ ਪਹਾੜ ਆਰਥਿਕ ਕਾਰਨ ਆਦਿ ਵੀ ਭਾਸ਼ਾਈ ਭਿੰਨਤਾ ਕਾਇਮ ਰੱਖਣ ਵਿੱਚ ਸਹਾਇਕ ਸਿੱਧ ਸੀ ਸੋ ਇੱਕ ਹੀ ਭਾਸ਼ਾ ਵਿੱਚ ਇਨ੍ਹਾਂ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀ ਉਪਭਾਸ਼ਾ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਦਰਿਆ ਸਤਲੁਜ ਬਿਆਸ ਰਾਵੀ ਚਿਨਾਬ ਅ ਅਤੇ ਜੇਹਲਮ ਆਦਿ ਦੇ ਇਲਾਕਿਆਂ ਵਿੱਚ ਪੈਦਾ ਹੋਈਆਂ ਹਨ ਕਿਸੇ ਵੀ ਉਪਭਾਸ਼ਾਵਾਂ ਦਾ ਘੇਰਾ ਖ਼ਾਸ ਇਲਾਕੇ ਤੱਕ ਸੀਮਤ ਹੁੰਦਾ ਹੈ ਪੰਜਾਬੀ ਭਾਸ਼ਾ ਅਸੀਂ ਹਰੇਕ ਥਾਂ 'ਤੇ ਵਰਤ ਸਕਦੇ ਹਾਂ ਇਹ ਭਾਸ਼ਾ ਅਖ਼ਬਾਰਾਂ ਰਸਾਲਿਆ ਆਦਿ ਵਿੱਚ ਵੀ ਵਰਤੀ ਜਾਂਦੀ ਹੈ ਇਸ ਭਾਸ਼ਾ ਨੂੰ ਛੋਟੇ ਬੱਚੇ ਅਤੇ ਮਤਲਬ ਕਿ ਛੋਟੇ ਬੱਚੇ ਹੋਰ ਵੀ ਵਧੀਆ ਢੰਗ ਨਾਲ ਬੋਲ ਸਕਦੇ ਆ ਅਤੇ ਇਹ ਭਾਸ਼ਾ ਪੰਜਾਬੀ ਭਾਸ਼ਾ ਸਭ ਤੋਂ ਜ਼ਰੂਰੀ ਹੈ